ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਮੈਂ ਕਿਹਾ ਕੀ ਹਾਲ ਨੇ ਜੀ ਵਧੀਆ ਵਧੀਆ ਤੁਹਾਡੇ ਪਿੰਡੋਂ ਬੋਲਣ ਡੇ ਜੇ ਮੈਂ ਕਿਹਾ ਮੋਟਰ ਖਰਾਬ ਹੋ ਗਈ ਜਿਹੜੀ ਪਹਿਲਾਂ ਠੀਕ ਕਰਵਾਈ ਸੀ ਦੇ ਦਿੰਦੇ ਹਾਂ ਤੁਹਾਡੇ ਕੋਲੋਂ ਪਹਿਲਾਂ ਵੀ ਠੀਕ ਕਰਵਾਈ ਆ ਫਿਰ ਇਹ ਹੀ ਹਾਲ ਹੋ ਗਿਆ ਹੁਣ ਦੱਸੋ ਕੀ ਕਰੀਏ ਹੋਇਆ ਕੁਛ ਨਹੀਂ ਬਸ ਮੇਰੀ ਗੱਲ ਸੁਣੋ ਬੱਤੀ ਨਾ ਘੱਟ ਵੱਧ ਹੋਈ ਸੀ ਅਤੇ ਉਹ ਲੋੜ੍ਹ ਜਿਹਾ ਪੈ ਗਿਆ ਮੋਟਰ 'ਤੇ ਅਤੇ ਮੋਟਰ ਦਾ ਨਾ ਸਾਈਡ 'ਚ ਧੂੰਆਂ ਜਿਹਾ ਨਿਕਲ ਗਿਆ ਕੀ ਹੋਇਆ ਫੂਕ ਹੋ ਗਈ ਆ ਅਤੇ ਮੈਂ ਕਿਹਾ ਕਿੰਨੇ ਪੈਸੇ ਲਓਗੇ ਫਿਰ ਬੰਨਣ ਦੇ ਹੁਣ ਫਿਰ ਮੈਂ ਕਿਹਾ ਪਿਛਲੀ ਵਾਰ ਤੁਸੀਂ ਨੋਂ ਸੌ ਲੈ ਲਿਆ ਸੀ ਇਸ ਵਾਰ ਕਿੰਨੇ ਕੁ ਲਓਗੇ ਮਾੜਾ ਮੋਟਾ ਘੱਟ ਵੱਧ ਕਰ ਲਿਓ ਇਸ ਵਾਰ ਚੱਲੋ ਕੋਈ ਨਹੀਂ ਫਿਰ ਦੇਖ ਲਾਂਗੇ ਅਤੇ ਉਹ ਮੇਰੀ ਗੱਲ ਸੁਣੋ ਇਸ ਵਾਰ ਤੁਸੀਂ ਤਾਂਬੇ ਨਾਲ ਬੰਨੋਗੇ ਕਿ ਸਿਲਵਰ ਨਾਲ ਬੰਨੋਗੇ ਹੁਣ ਤਾਂਬੇ ਨਾਲ ਵਧੀਆ ਕਰਕੇ ਬੰਨ ਦਿਓ ਮੈਂ ਕਿਹਾ ਇਸ ਵਾਰ ਫਿਰ ਨਾ ਸੜ ਜਾਵੇ ਮਾੜਾ ਜਿਹਾ ਪਾਣੀ ਪਵੇ ਤਾਂ ਸਾੜ ਜਾਂਦੀ ਆ ਜਾਂ ਫਿਰ ਤੁਸੀਂ ਦੱਸ ਦਿਓ ਜਾਂ ਨਵੀਂ ਮੋਟਰ ਲਗਵਾ ਲਈਏ ਕਿੰਨੇ ਦੀ ਪਵੇਗੀ ਚਾਰ ਹਜ਼ਾਰ ਦੀ ਇਹ ਕਿੰਨੇ ਦੀ ਹੈਗੀ ਆਪਣੀ ਇੱਕ ਹੋ ਇੱਕ ਹੋਸ ਪਾਵਰ ਦੀ ਜਾਂ ਅੱਧੀ ਦੀ ਚੱਲੋ ਠੀਕ ਹੈ ਫਿਰ ਦੇਖ ਲੈਂਦੇ ਹਾਂ ਅਤੇ ਕਦੋਂ ਤੱਕ ਆਓਗੇ ਚੱਲੋ ਠੀਕ ਆ ਕਰ ਦਿਓ ਫਿਰ ਤੁਸੀਂ ਦੇਖ ਲਿਓ ਸਤਿ ਸ਼੍ਰੀ ਅਕਾਲ ਜੀ